ਮੈਂ ਰੋਜਾਨਾ ਲਿਖਦੀ ਹਾਂ ਅਤੇ ਇਹ ਨਿਰੀਖਣ ਕਰਦੀ ਹਾਂ ਜਦ ਉਸ ਨੂੰ ਪੜਦੀ ਹਾਂ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਮੈਂ ਅੱਜ ਜੋ ਲਿਖਿਆ ਹੈ ਕੱਲ ਇਸ ਤੋਂ ਵੀ ਵਧੀਆ ਕੁਛ ਲਿਖਾਂ ਜਦੋਂ ਮੈਨੂੰ ਲਿਖਣ ਦਾ ਸ਼ੌਂਕ ਹੋਇਆ ਤਾਂ ਉਸ ਟਾਈਮ ਮੇਰੇ ਘਰ ਮੇਰੇ ਭਰਾ ਦਾ ਜਨਮ ਹੋਇਆ ਸੀ ਤਾਂ ਉਸ ਸਮੇਂ ਮੈਨੂੰ ਲੱਗਾ ਕਿ ਮੈਂ ਕੁਛ ਇੰਨਾ ਵਧੀਆ ਲਿਖਾਂ ਤਾਂ ਜੋ ਮੇਰਾ ਭਰਾ ਵੱਡਾ ਹੋ ਕੇ ਮੈਨੂੰ ਉਸ ਕੰਮ ਦੇ ਲਈ ਸ਼ਾਬਾਸ਼ੀ ਦੇ ਮੈਂ ਉਸਦੀ ਜ਼ਿੰਦਗੀ ਬਾਰੇ ਸਭ ਕੁਛ ਇੱਕ ਡਾਇਰੀ ਦੇ ਤੌਰ ਤੇ ਜਾਂ ਕਿ ਡਾਇਰੀ ਵਿੱਚ ਬਿਆਨ ਕਰਨਾ ਚਾਹੁੰਦੀ ਸੀ ਜੋ ਵੀ ਉਸਨੇ ਪਹਿਲੇ ਦਿਨ ਤੋਂ ਜਾਨੀ ਕਿ ਜਨਮ ਤੋਂ ਜੋ ਵੀ ਕੋਈ ਹਰਕਤ ਕੀਤੀ ਜਾਂ ਕਦੋਂ ਉਹ ਬੋਲਣਾ ਉਹਨੇ ਸ਼ੁਰੂ ਕੀਤਾ ਜਾਂ ਕਦੋਂ ਉਹਨੇ ਤੁਰਨਾ ਸ਼ੁਰੂ ਕੀਤਾ ਪਹਿਲਾ ਬੋਲ ਕਦੋਂ ਤੇ ਕੀ ਬੋਲ ਕੀਤਾ ਜਾਂ ਉਹਦੀ ਜ਼ਿੰਦਗੀ ਵਿੱਚ ਜੋ ਵੀ ਘਟਨਾਵਾਂ ਹੋਈਆਂ ਮੈਂ ਉਸ ਡਾਇਰੀ ਵਿੱਚ ਲਿਖਣੀਆਂ ਸ਼ੁਰੂ ਕੀਤੀਆਂ ਤੇ ਇਹ ਮੇਰੇ ਲਈ ਸਭ ਤੋਂ ਵੱਡੀ ਪ੍ਰੇਰਨਾ ਸੀ ਕਿ ਮੈਂ ਆਪਣੇ ਭਰਾ ਨੂੰ ਇੱਕ ਬਹੁਤ ਹੀ ਜਿਆਦਾ ਵਧੀਆ ਤੋਹਫਾ ਦੇਵਾਂ ਤਾਂ ਜੋ ਆਪਣੀ ਜ਼ਿੰਦਗੀ ਨੂੰ ਉਹ ਡੈਰੀ ਪੜ ਕੇ ਦੁਬਾਰਾ ਜੀਅ ਸਕੇ ਇਹ ਮੇਰੇ ਲਈ ਸਭ ਤੋਂ ਵਧੀਆ ਪ੍ਰੇਰਨਾ ਸੀ